ਘੁੰਮਣ ਲਈ ਸਾਡੇ ਇਲਾਕੇ ਵਿੱਚ ਬਹੁਤ ਹੀ ਜਗ੍ਹਾ ਜਗ੍ਹਾ ਹਨ ਜਿੱਥੇ ਕਿ ਤੁਸੀਂ ਘੁੰਮ ਸਕਦੇ ਹੋ ਬਹੁਤ ਜਿੱਦਾਂ ਕਿ ਬਹੁਤ ਸਾਰੀਆਂ ਨਹਿਰਾਂ ਹੈ ਹੋਰ ਵੀ ਪਾਰਕ ਬਣੇ ਹੈ ਲਾਗੇ ਛਾਗੇ ਜਿੱਥੇ ਤੁਸੀਂ ਘੁੰਮ ਸਕਦੇ ਹੋ ਤੁਹਾਡਾ ਦਿਮਾਗ ਇੱਕਦਮ ਠੰਡਾ ਹੋਵੇਗਾ ਅਗਰ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਕਰਦਾ ਤਾਂ ਤੁਸੀਂ ਰਿਲੈਕਸ ਫੀਲ ਹੋ ਜਾਣਾ ਨਾਲ ਜਿੱਦਾਂ ਕਿ ਸਾਡੇ ਲਾਗੇ ਵੱਖਰੇ ਵੱਖਰੇ ਮੇਲੇ ਲੱਗਦੇ ਜਿੱਦਾਂ ਮਾਘੀ ਦਾ ਮੇਲਾ ਹੋ ਗਿਆ ਦੁਸਹਿਰੇ ਦਾ ਮੇਲਾ ਹੋ ਗਿਆ ਉਹ ਮੇਲੇ 'ਚ ਜਾ ਕੇ ਤੁਸੀਂ ਆਪਣੇ ਆਪ ਨੂੰ ਇੱਕਦਮ ਮਜ਼ੇ ਨਾਲ ਤੁਸੀਂ ਘੁੰਮ ਫਿਰ ਕੇ ਗੇੜੀਆਂ ਗੁੜੀਆਂ ਮਾਰ ਕੇ ਚੰਗੀ ਤਰ੍ਹਾਂ ਘੁੰਮ ਸਕਦੇ ਹੋ ਸਾਡੇ ਉੱਥੇ ਲੱਗਦਾ ਇੱਕ ਸ਼ਿਵਰਾਤਰੀ ਦਾ ਮੇਲਾ ਲੱਗਦਾ ਬਨੀ ਬਨੀ ਜਾ ਕੇ ਤੁਸੀਂ ਇਹੀ ਭਗਤੀ 'ਚ ਲੀਨ ਹੋ ਜਾਣਾ ਅਤੇ ਕਿਸੇ ਹੋਰ ਨੂੰ ਦਿਖਣਾ ਹੀ ਨਹੀਂ ਉੱਥੇ ਇਹਦੀ ਮਾਨਤਾ ਹੈ ਕਿ ਉੱਥੇ ਬੂਟੇ ਆਪ ਚੱਲ ਕੇ ਆਉਂਦੇ ਹੈ ਬਨੀ ਇਸ ਕਰਕੇ ਤੁਸੀਂ ਇੱਕੋ ਵਾਰੀ ਬਨੀ ਜ਼ਰੂਰ ਜਾਣਾ ਤੁਹਾਨੂੰ ਬਹੁਤ ਮਜ਼ਾ ਆਉਣਾ ਅਨੰਦ ਆਉਣਾ ਤੁਹਾਨੂੰ ਇਸ ਕਰਕੇ ਮੇਰਾ ਇਹ ਸੁਝਾਅ ਹੈ ਕਿ ਜਦੋਂ ਵੀ ਤੁਸੀਂ ਜਾਓ ਤੁਸੀਂ ਗਰਮੀਆਂ 'ਚ ਨਾ ਜਾਓ ਨਾ ਹੀ ਤੁਸੀਂ ਸਰਦੀਆਂ 'ਚ ਜਾਓ ਜਿੱਦਾਂ ਮਿਕਸ ਮਿਕਸ ਮੌਸਮ ਹੋਏਗਾ ਫਿਰ ਤੁਸੀਂ ਉਦੋਂ ਜਾਇ